ਮੈਂ ਆਪਣਾ ਆਧਾਰ ਕਾਰਡ ਔਨਲਾਈਨ ਅਪਡੇਟ ਕਰਨ ਲਈ ਬੇਨਤੀ ਜਮ੍ਹਾਂ ਕਰਵਾਈ ਹੈ ਹੁਣ ਮੈਨੂੰ ਇਹ ਚਿੰਤਾ ਹੋ ਰਹੀ ਹੈ ਕਿ ਮੇਰਾ ਡਾਟਾ ਸੁਚਾਰੂ ਢੰਗ ਨਾਲ ਅਪਡੇਟ ਹੋ ਵੀ ਰਿਹਾ ਹੈ ਜਾਂ ਨਹੀਂ ਮੈਨੂੰ ਇਹ ਵੀ ਚਿੰਤਾ ਹੈ ਕਿ ਕਿਤੇ ਮੈਂ ਗਲਤ ਸਾਈਟ 'ਤੇ ਆਪਣਾ ਡਾਟਾ ਅਪਡੇਟ ਤਾਂ ਨਹੀਂ ਕਰ ਦਿੱਤਾ ਹੁਣ ਮੈਨੂੰ ਵਾਪਿਸ ਉਹ ਸਾਈਟ ਖੋਲ੍ਹ ਕੇ ਆਪਣਾ ਡਾਟਾ ਦੇਖਣਾ ਚਾਹੀਦਾ ਹੈ ਅਤੇ ਇਹ ਕੰਮ ਕਦੋਂ ਤੱਕ ਪੂਰਾ ਹੋਣਾ ਹੈ ਇਸਦੀ ਵੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ